ਸਤਿ ਸ਼੍ਰੀ ਅਕਾਲ ਮੈਨੂੰ ਟੈਕਨੋਲੋਜੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਅਤੇ ਉਸ 'ਤੇ ਭਰੋਸਾ ਵੀ ਹੋ ਹੋਣ ਲੱਗ ਪਿਆ ਹੈ ਜਿੱਦਾਂ ਕਿ ਪਹਿਲਾਂ ਮੈਂ ਸਵੇਰੇ ਜਲਦੀ ਉੱਠ ਜਾਂਦੀ ਸੀ ਜਿੱਦਾਂ ਜਿੱਦਾਂ ਉਮਰ ਵੱਧ ਰਹੀ ਹੈ ਤਾਂ ਆਦਤਾਂ ਵਿਗੜਦੀਆ ਜਾ ਰਹੀਆਂ ਹਨ ਉਸਦੇ ਕਾਰਨ ਮੈਨੂੰ ਇੱਕ ਅਲਾਰਮ ਘੜੀ ਦੀ ਜ਼ਰੂਰਤ ਪੈਂਦੀ ਹੈ ਹਾਂ ਉਸ ਆਲਾਰਮ ਘ ਉਹ ਆਲਾਰਮ ਘੜੀ ਬਹੁਤ ਹੀ ਮੇਰੀ ਮਦਦ ਕਰਦੀ ਹੈ ਜਿਸ ਟਾਈਮ 'ਤੇ ਸੋਚਦੀ ਹਾਂ ਕਿ ਇਸ ਟਾਈਮ 'ਤੇ ਉੱਠਣਾ ਹੀ ਉੱਠਣਾ ਹੈ ਤਾਂ ਉਸ ਟਾਈਮ 'ਤੇ ਮੈਂ ਅਲਾਰਮ ਲਗਾ ਦਿੰਦੀ ਹਾਂ ਉਸ ਨਾਲ ਉਹ ਘੜੀ ਮੇਰੀ ਬਹੁਤ ਹੀ ਮਦਦ ਕਰਦੀ ਹੈ ਦੂਸਰਾ ਜਿੱਦਾਂ ਕਿ ਪਹਿਲਾਂ ਮੈਂ ਨੋਟਸ ਬਣਾਉਂਦੀ ਸੀ ਕੋਪੀਆ 'ਤੇ ਲਿਖਦੀ ਰਹਿੰਦੀ ਸੀ ਫਿਰ ਮੈਨੂੰ ਪਤਾ ਲੱਗਿਆ ਕਿ ਫੋਨ ਵਿੱਚ ਇੱਕ ਇੱਦਾਂ ਦਾ ਐਪ ਵੀ ਹੁੰਦਾ ਹੈ ਜਿਸ 'ਤੇ ਮੈਂ ਨੋਟਸ ਲਿਖ ਸਕਦੀ ਹਾਂ ਟਾਈਪ ਕਰਕੇ ਰੱਖ ਸਕਦੀ ਹਾਂ ਉਹ ਨੋਟਸ ਐਪ ਹੈ ਤੀਸਰਾ ਜਦੋਂ ਉਸ ਜਦੋਂ ਪਹਿਲਾਂ ਪਹਿਲਾਂ ਮੈਂ ਬਹੁਤ ਹੀ ਜ਼ਿਆਦਾ ਮਿਹਨਤ ਕਰਦੀ ਸੀ ਆਪ ਹੀ ਸੋਚ ਸੋਚ ਕੇ ਇੱਕ ਕਾਪੀ 'ਤੇ ਲਿਖਦੀ ਰਹਿੰਦੀ ਸੀ ਜਦੋਂ ਕੋਈ ਸਰ ਪੜ੍ਹਾਏ ਫਿਰ ਉਹਨੂੰ ਕਾਪੀ 'ਤੇ ਲਿਖਦੀ ਸੀ ਹੁਣ ਮੈਂ ਉਹ ਆਪਣੇ ਪਹਿਲਾਂ ਹੀ ਦਿਮਾਗ ਵਿੱਚ ਸੋਚ ਲੈਂਦੀ ਹਾਂ ਫਿਰ ਉਹਨੂੰ ਗੂਗਲ 'ਤੇ ਸਰਚ ਕਰਕੇ ਉਹਦੀ ਸਾਰੀ ਹੀ ਹਿਸਟਰੀ ਕੱਢ ਲੈਂਦੀ ਹਾਂ ਉਹਦੇ ਸਾਰੇ ਹੀ ਇਤਿਹਾਸ ਬਾਰੇ ਲਿਖ ਲੈਂਦੀ ਹੈ ਜੋ ਕਿ ਸਭ ਕੁਛ ਉਪਲੱਬਧ ਮਿਲ ਜਾਂਦਾ ਹੈ ਗੂਗਲ ਐਪ ਵੀ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਧੰਨਵਾਦ